ਅਸੀਂ ਉਹਨਾਂ ਨਾਲ ਸਮਾਂ ਬਿਤਾਉਣ ਅਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਦੇ ਤਰੀਕੇ ਨਾਲ ਹੋਰ ਮੈਂਬਰਾਂ ਪਰਿਵਾਰ ਅਤੇ ਰਸੋਈ ਨੂੰ ਇਸ ਤਰ੍ਹਾਂ ਸਾਂਝਾ ਕਰਨਾ ਚਾਹਵਾਂਗੇ ਜਿਵੇਂ ਕਿ ਮੇਰੇ ਤੋਂ ਪਹਿਲਾਂ ਕੁਛ ਗਲਤੀ ਹੋਈ ਸੀ ਮੇਰੇ ਤੋਂ ਗਲਤੀ ਨਾਲ ਰੋਟੀਆਂ ਜਲ਼ ਗਈਆਂ ਸੀ ਅਤੇ ਮੇਰਾ ਹੱਥ ਵੀ ਜਲ਼ ਗਿਆ ਸੀ ਅਤੇ ਉਸ ਉਸ ਸਮੇਂ ਤੋਂ ਮੈਂ ਅਤੇ ਮੇਰੇ ਮਾਤਾ ਜੀ ਅਸੀਂ ਇਕੱਠੇ ਰਸੋਈ ਦੇ ਵਿੱਚ ਕੰਮ ਕਰਦੇ ਹਾਂ